ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਸੋਚ ਰਹੀ ਹਾਂ ਅਤੇ ਇਹ ਕਾਰੋਬਾਰ ਹੈ ਵਾਸ਼ਿੰਗ ਸੈਂਟਰ ਦਾ ਜਿਹਨੂੰ ਸਰਵਿਸ ਸਟੇਸ਼ਨ ਵੀ ਕਿਹਾ ਜਾਂਦਾ ਹੈ ਆਮ ਭਾਸ਼ਾ ਦੇ ਵਿੱਚ ਹਲਾਂ ਕਿ ਸਾਡੇ ਸ਼ਹਿਰ ਵਿੱਚ ਇਹੋ ਜਿਹੇ ਬਹੁਤ ਹੀ ਘੱਟ ਸਰਵਿਸ ਸਟੇਸ਼ਨ ਨੇ ਤਾਂ ਜੋ ਮੈਂ ਸੋਚਿਆ ਕਿ ਕਿਉਂ ਨਾ ਮੈਂ ਇਹ ਕੰਮ ਸ਼ੁਰੂ ਕਰ ਸਕਾਂ ਸਰਵਿਸ ਸਟੇਸ਼ਨ ਘੱਟ ਹੋਣ ਦਾ ਕਾਰਨ ਇਹ ਹੀ ਹੈ ਕਿ ਸਾਡੇ ਇਲਾਕੇ ਵਿੱਚ ਪਾਣੀ ਦੀ ਬਹੁਤ ਹੀ ਘਾਟ ਹੈ ਪਾਣੀ ਪ੍ਰੋਪਰ ਸਪਲਾਈ ਨਹੀਂ ਹੁੰਦੀ ਤਾਂ ਜੋ ਮੇਰੀ ਇਹ ਬੇਨਤੀ ਹੈ ਕਿ ਜਿੱਥੇ ਵੀ ਮੈਂ ਕੰਮ ਸ਼ੁਰੂ ਕਰਾਂ ਉੱਥੇ ਮੈਨੂੰ ਪਾਣੀ ਦੀ ਬਿਲਕੁਲ ਵੀ ਘਾਟ ਨਾ ਹੋਵੇ ਅਤੇ ਜੋ ਕਨੈਕਸ਼ਨ ਮਿਲੇ ਮੈਨੂੰ ਪਾਣੀ ਦਾ ਉਹ ਬਹੁਤ ਹੀ ਵਧੀਆ ਹੋਵੇ ਜਿੱਥੇ ਪੂਰੇ ਦਿਨ 'ਚ ਚਾਰ ਘੰਟੇ ਪਾਣੀ ਆਉਂਦਾ ਇੱਕ ਥਾਂ 'ਤੇ ਉਥੇ ਸਾਨੂੰ ਪੂਰਾ ਦਿਨ ਪਾਣੀ ਮਿਲੇ ਤਾਂ ਜੋ ਲੋਕ ਵੀ ਸੁਖੀ ਰਹਿਣ ਅਤੇ ਮੇਰਾ ਕੰਮ ਵੀ ਵਧੀਆ ਚੱਲ ਸਕੇ ਵੈਸੇ ਇਹ ਕੰਮ ਤਾਂ ਮੈਂ ਆਪਣੇ ਘਰ ਦੇ ਨੇੜੇ ਫਲਾਈਓਵਰ ਦੇ ਕੋਲ ਮਲੋਹ ਚੌਂਕ 'ਤੇ ਸ਼ੁਰੂ ਕਰਨ ਦਾ ਸੋਚ ਰਹੀ ਹਾਂ ਕਿਉਂਕਿ ਉੱਥੇ ਆਵਾਜਾਈ ਬਹੁਤ ਹੈ ਟਰੱਕ ਟਰੈਕਟਰ ਸਕੂਟਰ ਮੋਟਰਸਾਈਕਲ ਬਾਈਕ ਸਾਰੇ ਵਾਹਨ ਉੱਥੇ ਆਰਾਮ ਨਾਲ ਆ ਸਕਦੇ ਹਨ ਨਾ ਕੋਈ ਭੀੜੀ ਨਾ ਕੋਈ ਤੰਗ ਕੋਈ ਇਹੋ ਜਿਹੀ ਜਗ੍ਹਾ ਵੀ ਨਹੀਂ ਹੈ ਕਿ ਜਿੱਥੇ ਇਹਨਾਂ ਵਾਹਨਾਂ ਦਾ ਆਉਣਾ ਮੁਸ਼ਕਿਲ ਹੋਵੇ ਅਤੇ ਨਾਲ ਹੀ ਮੈਂ ਹਰ ਨਿਯਮ ਦੀ ਪਾਲਣਾ ਕਰਨ ਦਾ ਪੂਰਾ ਪੂਰਾ ਅਧਿਕਾਰ ਰੱਖਾਂਗੀ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਬਿਲਕੁਲ ਪਾਣੀ ਵੇਸਟ ਨਹੀਂ ਹੋਣ ਦੇਵਾਂਗੀ ਤਾਂ ਜੋ ਤੁਹਾਨੂੰ ਕਦੇ ਪਛਤਾਵਾ ਨਾ ਹੋਵੇ ਕਿ ਅਸੀਂ ਇਹਨਾਂ ਨੂੰ ਪਾਣੀ ਜ਼ਿਆਦਾ ਦੇ ਦਿੱਤਾ ਅਤੇ ਮੇਰਾ ਕਾਰੋਬਾਰ ਵਧੀਆ ਚੱਲੇ ਇਸ ਕਾਰਨ ਮੈਂ ਇਹ ਚਾਹੁੰਦੀ ਹਾਂ ਕਿ ਮੈਨੂੰ ਪਾਣੀ ਦਾ ਕਨੈਕਸ਼ਨ ਵਧੀਆ ਮਿਲੇ ਮੈਨੂੰ ਆਸ਼ ਆਸ ਹੈ ਕਿ ਤੁਸੀਂ ਮੇਰੀ ਗੱਲ ਨੂੰ ਮੰਨੋਗੇ ਅਤੇ ਮੈਨੂੰ ਜਲਦੀ ਤੋਂ ਜਲਦੀ ਦੱਸੋਗੇ ਕਿ ਮੇਰੀ ਇਹ ਬੇਨਤੀ ਮਨਜ਼ੂਰ ਹੋਈ ਜਾਂ ਨਹੀਂ ਹੋਈ